ਭੰਗੜੇ ਦੇ ਬਹੁਤ ਸਾਰੇ ਸਟੈਪ ਪ੍ਰਚਲਿਤ ਹਨ ਜਿਨ੍ਹਾਂ ਵਿੱਚੋਂ ਕੁਝ ਹਨ ਲੁੱਡੀ ਧਮਾਲ ਆਦਿ ਇਹ ਸਭ ਬਹੁਤ ਹੀ ਚੰਗੇ ਸਟੈਪ ਹਨ ਜਿਨ੍ਹਾਂ ਨੂੰ ਪੰਜਾਬੀ ਗੱਬਰੂ ਭੰਗੜੇ ਦੇ ਲਈ ਵਰਤਦੇ ਹਨ ਅਤੇ ਪੰ ਇਹ ਪੰਜਾਬੀ ਸੱਭਿਆਚਾਰ ਦੀ ਜੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਪੰਜਾਬੀ ਗੱਬਰੂ ਵੱਖ ਵੱਖ ਤਰ੍ਹਾਂ ਦੇ ਸਟੈਪ ਕਰਕੇ ਭੰਗੜੇ ਨੂੰ ਵੱਖ ਵੱਖ ਤਰ੍ਹਾਂ ਨਾਲ ਪੇਸ਼ ਕਰਦੇ ਹਨ ਅਤੇ ਇੱਕ ਚੰਗਾ ਪ੍ਰਦਰਸ਼ਨ ਵਿਖਾਉਂਦੇ ਹਨ ਜਿਸ ਦੇ ਨਾਲ ਬਹੁਤ ਸਾਰੇ ਲੋਕ ਇਸਨੂੰ ਦੇਖ ਕੇ ਖੁਸ਼ ਹੁੰਦੇ ਹਨ ਅਤੇ ਭੰਗੜੇ ਨੂੰ ਇੱਕ ਬਹੁਤ ਚੰਗਾ ਨਾਚ ਸਮਝਦੇ ਹਨ ਇਹ ਇੱਕ ਜਸ਼ਨ ਦਾ ਬਹੁਤ ਵੱਡਾ ਨਾਚ ਹੈ ਇਸ ਦੇ ਨਾਲ ਵਿਅਕਤੀ ਦੇ ਅੰਦਰ ਬਦੋ ਬਦੀ ਖੁਸ਼ੀ ਹੋਣ ਲੱਗ ਜਾਂਦੀ ਹੈ